ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੁਦਾ ਹੈ ਅਤੇ ਮੈਂ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਆਪਣੇ ਕੁਕਿੰਗ ਦੇ ਪਹਿਲੇ ਐਕਸਪੀਰੀਐਂਸ ਬਾਰੇ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਮੈਂ ਪਹਿਲੀ ਵਾਰ ਜਦੋਂ ਕੁਕਿੰਗ ਕੀਤੀ ਸੀ ਤਾਂ ਮੈਂ ਆਪਣੀ ਮਾਤਾ ਜੀ ਅਤੇ ਆਪਣੇ ਦੋਸਤਾਂ ਦੀ ਯੂਟਿਊਬ ਰਾਹੀਂ ਥੋੜ੍ਹੀ ਬਹੁਤ ਜਾਣਕਾਰੀ ਲਈ ਸੀ ਪਰ ਮੈਂ ਦੇਖਿਆ ਤਾਂ ਸਹੀ ਪਰ ਜੋ ਕਰਨਾ ਸੀ ਉਹ ਤਾਂ ਆਪ ਹੀ ਕਰਨਾ ਪੈਣਾ ਸੀ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਦਾਲ ਚਾਵਲ ਬਣਾਏ ਸੀ ਦਾਲ ਵਿੱਚ ਮੈਂ ਬਹੁਤ ਜ਼ਿਆਦਾ ਮਿਹਨਤ ਤਾਂ ਕੀਤੀ ਸੀ ਪਰ ਉਹਦੇ ਵਿੱਚ ਇੰਨੀ ਪ੍ਰਫੈਕਸ਼ਨ ਨਹੀਂ ਸੀ ਆਈ ਥੋੜ੍ਹਾ ਜਿਹਾ ਨਮਕ ਕਮ ਹੋ ਗਿਆ ਸੀ ਅਤੇ ਮੈਂ ਹੌਲੀ ਹੌਲੀ ਕਰਦੇ ਕਰਦੇ ਮੇਰਾ ਪਰਫੈਕਸ ਨਮਕ ਥੋੜ੍ਹਾ ਬਹੁਤਾ ਠੀਕ ਹੋ ਗਿਆ ਅਤੇ ਮੈਂ ਹੁਣ ਪਰਫੈਕਟ ਹੋ ਚੁੱਕੀ ਹਾਂ ਅਤੇ ਮੈਂ ਹੁਣ ਦਾਲ ਚਾਵਲ ਹੁਣ ਅੱਗੇ ਮੈਂ ਚਾਵਲ ਦੀ ਗੱਲ ਕਰਦੀ ਹਾਂ ਚਾਵਲ ਕਿ ਜਿਵੇਂ ਚਾਵਲ ਬੰਦਾ ਪਾਣੀ ਡਾਲ ਕੇ ਚੋਲ ਡਾਲ ਕੇ ਬਣਾਉਂਦਾ ਹੈ ਤਾਂ ਕਿਸੇ ਟੈਮ ਬਹੁਤ ਢਿੱਲੇ ਬਣ ਜਾਂਦੇ ਹੈ ਜਾਂ ਫਿਰ ਸਹੀ ਮਤਲਬ ਉਹ ਮੇਰੇ ਕੋਲ ਥੋੜ੍ਹੇ ਫਸਟ ਟਾਈਮ ਥੋੜ੍ਹੇ ਜਿਹੇ ਢਿੱਲੇ ਬਣ ਗਏ ਸੀ ਪਰ ਮੇਰੇ ਘਰਦਿਆਂ ਨੇ ਮੈਨੂੰ ਕੁਛ ਵੈਸਾ ਨਹੀਂ ਕਿਹਾ ਉਨ੍ਹਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੌਲੀ ਹੌਲੀ ਬੰਦਾ ਸ਼ੁਰੂਆਤ ਕਰਦਾ ਹਰੇਕ ਚੀਜ਼ ਦੀ ਬੰਦਾ ਟਰਾਏ ਕਰੇਗਾ ਕੋਈ ਚੀਜ਼ ਨੂੰ ਇੱਕ ਵਾਰ ਦੋ ਵਾਰ ਗਲਤ ਹੋਵੇਗੀ ਅਗਲੀ ਵਾਰੀ ਤੁਹਾਡੇ ਕੋ ਆਪਣੇ ਆਪ ਹੀ ਉਸ ਚੀਜ਼ ਵਿੱਚ ਪ੍ਰਫੈਕਸ਼ਨ ਆ ਜਾਵੇਗੀ ਅਤੇ ਤੁਸੀਂ ਹਾਰ ਨਹੀਂ ਮੰਨਣੀ ਅਤੇ ਇਸ ਨੂੰ ਮਤਲਬ ਕਰਦੇ ਰਹਿਣਾ ਹੈ ਤਾਂ ਕਿ ਤੁਹਾਡੀ ਵਿੱਚ ਪ੍ਰਫੈਕਸ਼ਨ ਆ ਜਾਵੇ ਤਾਂ ਹੁਣ ਮੈਂ ਕੁਕਿੰਗ ਸਹੀ ਤਰ੍ਹਾਂ ਕਰ ਲੈਂਦੀ ਹਾਂ ਪਰ ਇਸਨੂੰ ਕਰਦੇ ਰਹੋ ਤਾਂ ਵਧੀਆ ਗੱਲ ਹੈ